ਪਿਛਲੇ ਹਫ਼ਤੇ ਦੀ ਗੱਲ ਹੈ ਮੈਂ ਚੰਡੀਗੜ੍ਹ ਤੋਂ ਨਵਾਂਸ਼ਹਿਰ ਆਪਣੇ ਪਿੰਡ ਲਈ ਆ ਰਿਹਾ ਸੀ ਤਾਂ ਬੱਸ ਵਿੱਚ ਮੈਨੂੰ ਇੱਕ ਬੰਦਾ ਮਿਲਿਆ ਜਿਸ ਨੇ ਮੇਰੇ ਨਾਲ ਦੀ ਸੀਟ ਨਾਲ ਮੇਰੀ ਨਾਲ ਦੀ ਸੀਟ 'ਤੇ ਹੀ ਬੈਠਾ ਵਾ ਸੀ ਉਸ ਨੇ ਆਪਣੇ ਬਾਰੇ ਗੱਲਬਾਤ ਕਰਨੀ ਸ਼ੁਰੂ ਕੀਤੀ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਹ ਪੂਰੇ ਹੀ ਭਾਰਤ ਵਿੱਚ ਘੁੰਮਿਆ ਵਾ ਹੈ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਜਾਣਦਾ ਸੀ ਕਿੱਥੇ ਦਾ ਕਿਆ ਟ੍ਰੈਡੀਸ਼ਨ ਹੈ ਕਿੱਥੇ ਦੇ ਕ ਕਿਆ ਤਿਉਹਾਰ ਨੇ ਕਿਆ ਖਾਣ ਪਾਣ ਹੈ ਉਸ ਬਾਰੇ ਉਸ ਨੇ ਕਈ ਚੀਜ਼ਾਂ ਮੈਨੂੰ ਦੱਸੀਆਂ ਅਤੇ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਨੂੰ ਨਵੀਂਆਂ ਨਵੀਂਆਂ ਥਾਵਾਂ ਬਾਰੇ ਦੱਸਿਆ ਜਿਸ ਬਾਰੇ ਜਿ ਮੈਨੂੰ ਅੱਜ ਤੱਕ ਨੌਲੇਜ ਹੀ ਨਹੀਂ ਸੀਗੀ ਦੋ ਸਾਲ ਤੋਂ ਬੰਦਾ ਘੁੰਮ ਰਿਹਾ ਸੀ ਉਸਨੂੰ ਕਈ ਚੀਜ਼ਾਂ ਇੱਦਾਂ ਦੀਆਂ ਪਤਾ ਸੀ ਜਿਹੜੀਆਂ ਅਸੀਂ ਸੁਣੀਆਂ ਹੀ ਨਹੀਂ ਸੀ ਸੋ ਉਹਨੇ ਕਈ ਚੀਜ਼ਾਂ ਮੈਨੂੰ ਇੱਦਾਂ ਦੀਆਂ ਦੱਸੀਆਂ ਜੋ ਮੈਨੂੰ ਬਹੁਤ ਹੀ ਚੰਗੀਆਂ ਲੱਗੀਆਂ